ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦਸ਼ਮੇਸ਼ ਟੂਰਿਸਟ ਤੋਂ ਬਲਜਿੰਦਰ ਗੱਲ ਕਰਦਾ ਜੀ ਅਨੰਦਪੁਰ ਸਾਹਿਬ ਜੀ ਕੋਈ ਗੱਲ ਨਹੀਂ ਮਿਲਜੂ ਕਿੰਨੀਆਂ ਸਵਾਰੀਆਂ ਜੀ ਫੈਮਿਲੀ ਦੇ ਪੰਜ ਜਣੇ ਹੋ ਜੀ ਕੋਈ ਗੱਲ ਨਹੀਂ ਜੀ ਤੁਹਾਨੂੰ ਵਧੀਆ ਗੱਡੀ ਦੇਵਾਂਗੇ ਨਹੀਂ ਨਹੀਂ ਉਹ ਤੁਸੀਂ ਫਿਕਰ ਨਾ ਕਰੋ ਜੀ ਡਰਾਈਵਰ ਸਾਡਾ ਪਹਿਲਾਂ ਵੀ ਜਾਂਦਾ ਆਉਂਦਾ ਰਹਿੰਦਾ ਅਨੰਦਪੁਰ ਸਾਹਿਬ ਜੀ ਤੁਹਾਨੂੰ ਸਾਰੇ ਅਨੰਦਪੁਰ ਸਾਹਿਬ ਵਧੀਆ ਘੁੰਮਾਊਗਾ ਜੀ ਗੱਡੀ ਤੁਹਾਨੂੰ ਪੂਰੀ ਵਧੀਆ ਫਰੈਸ਼ ਭੇਜਾਂਗੇ ਏ ਸੀ ਚੱਲਦਾ ਜੀ ਗਰਮੀ ਦਾ ਸਮਾਂ ਜੀ ਕੋਈ ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦਾ ਉਹ ਜਾਣਕਾਰ ਹੈ ਜੀ ਸਾਰੇ ਸਾਰੀ ਗੱਡੀ ਮੰਨ ਲਓ ਵੀ ਕਾ ਵਧੀਆ ਵਿੱਚੋਂ ਤਿਆਰ ਕੀਤੀ ਹੋਈ ਹੈ ਜੀ ਸੀਟਾਂ ਸੂਟਾਂ ਪੂਰੀ ਸਫ਼ਾਈ ਰੱਖਦਾ ਜੀ ਡਰਾਈਵਰ ਤੁਹਾਨੂੰ ਕਿਸੇ ਦਿੱਕਤ ਨਹੀਂ ਆਉਂਦੀ ਜੀ ਡਰਾਈਵਰ ਸਾਡਾ ਪੂਰਾ ਜਾਣਕਾਰ ਹੈ ਜੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਬਾਈ ਜੀ ਜਦੋਂ ਤੁਸੀਂ ਸਾਨੂੰ ਫੋਨ ਕਰ ਲਿਆ ਸਮਝ ਲਓ ਵੀ ਕੋਈ ਦਿੱਕਤ ਹੀ ਨਹੀਂ ਆਉਣ ਦਿੰਦਾ ਡਰਾਈਵਰ ਤੁਹਾਨੂੰ ਸਾਡਾ ਡਰਾਈਵਰ ਬਹੁਤ ਵਰੀ ਬਾਹਰ ਜਾਂਦਾ ਆਉਂਦਾ ਰਹਿੰਦਾ ਬਾਈ ਜੀ ਗੱਡੀ ਵੀ ਵਧੀਆ ਭੇਜਾਂਗੇ ਪੂਰੀ ਸਾਫ਼ ਗੱਡੀ ਭੇਜਾਂਗੇ ਬਾਈ ਜੀ ਦਸ ਰੁਪਏ ਕਿਲੋਮੀਟਰ ਦੇ ਲੱ ਲੱਗਣਗੇ ਬਾਈ ਜੀ ਵੈਸੇ ਤਾਂ ਬਾਜ਼ਾਰ ਚੋਂ ਗਿਆਰਾਂ ਬਾਰਾਂ ਚੱਲਦਾ ਜੀ ਰੇਟ ਪਰ ਤੁਹਾਨੂੰ ਫੈਮਲੀ ਦਾ ਕੰਮ ਹੈ ਧਾਰਮਿਕ ਜਗ੍ਹਾ 'ਤੇ ਜਾਣਾ ਦਸ ਰੁਪਏ ਕਿਲੋਮੀਟਰ ਦੇ ਲਵਾਂਗੇ ਜੀ ਉਹ ਜਾਣਦਾ ਜੀ ਤੁਹਾਨੂੰ ਆਨੰਦਪੁਰ ਸਾਹਿਬ ਸਾਰਾ ਘੁੰਮਾਉਗਾ ਜੀ ਤੁਹਾਨੂੰ ਜਿੰਨੀਆਂ ਵੀ ਜਗ੍ਹਾ ਜੀ ਹੋਲੇ ਮਹੱਲਾ ਮੰਨ ਲਓ ਵੀ ਹੋਲਾ ਮਹੱਲਾ ਮਨਾਇਆ ਜਾਊਗਾ ਜੀ ਉੱਥੇ ਹੋਲੇ ਮਹੱਲੇ 'ਤੇ ਇਕੱਠ ਬਹੁਤ ਹੁੰਦਾ ਜੀ ਸਾਡਾ ਡਰਾਈਵਰ ਜਾਣਦਾ ਤੁਹਾਨੂੰ ਹੋਲਾ ਮਹੱਲਾ ਸਾਰਾ ਦਿਖਾ ਕੇ ਲਿਆਊਗਾ ਜੀ ਵਧੀਆ ਹੋਲੇ ਮਹੱਲੇ 'ਤੇ ਉੱਥੇ ਜੋ ਘੋੜਿਆਂ ਦੇ ਨਾਲ ਪ੍ਰਦਰਸ਼ਨੀਆਂ ਕੀਤੀਆਂ ਜਾਂਦੀਆਂ ਉਹ ਸਭ ਕੁਛ ਦਿਖਾ ਕੇ ਲੈ ਕੇ ਆਊਗਾ ਜੀ ਕੰਪੀਟੀਸ਼ਨ ਮੁਕਾਬਲੇ ਕਰਵਾਏ ਜਾਂਦੇ ਆ ਜੀ ਹੋਲੇ ਮਹੱਲੇ ਤੇ ਤੁਹਾਨੂੰ ਸਾਰੀ ਫੈਮਿਲੀ ਨੂੰ ਵਧੀਆ ਪੂਰਾ ਸੰਤੁਸ਼ਟੀ ਨਾਲ ਦਿਖਾ ਕੇ ਲਿਆਊਗਾ ਬਾਈ ਜੀ ਬਸ ਤੁਸੀਂ ਸ਼ਾਮ ਨੂੰ ਫਾਈਨਲ ਕਰ ਦਿਓ ਜੀ ਕੱਲ੍ਹ ਨੂੰ ਫਿਰ ਸੁਬਾਹ ਤੁਹਾਡੇ ਕੋਲ ਡਰਾਈਵਰ ਆ ਜੂਗਾ ਜੀ ਜਿੰਨੇ ਵਜੇ ਤੁਸੀਂ ਕਹੋਗੇ ਉੰਨੇ ਵਜੇ ਤੁਹਾਡੇ ਕੋਲ ਘਰ ਤੁਹਾਡੇ ਕੋਲ ਪਹੁੰਚ ਜੂਗਾ ਜੀ ਘਰ ਗੱਡੀ ਲੈ ਕੇ ਧੰਨਵਾਦ ਬਾਈ ਜੀ ਕੋਈ ਗੱਲ ਨਹੀਂ ਓਕੇ ਜੀ